ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੋਈ ਨਵੀਂ ਚੀਜ਼ ਦੇਖਣ ਨੂੰ ਮਿਲਦੀ ਹੈ ਜਾਂ ਕੋਈ ਨਵਾਂ ਤਜ਼ਰਬਾ ਮੈਂ ਦੇਖ ਰਹੀ ਹੁੰਦੀ ਹਾਂ ਤਾਂ ਉਦੋਂ ਮੈਂ ਕੈਮਰੇ ਦੀ ਵਰਤੋਂ ਜ਼ਰੂਰ ਕਰਦੀ ਹਾਂ ਤਾਂ ਕਿ ਮੈਂ ਉਹ ਤਸਵੀਰਾਂ ਆਪਣੇ ਘਰਦਿਆਂ ਦੇ ਨਾਲ ਸ਼ੇਅਰ ਕਰ ਸਕਾਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰ ਸਕਾਂ ਕਿ ਜੋ ਮੈਂ ਨਵੇਂ ਨਵੇਂ ਅਨੁਭਵ ਕੀਤੇ ਹਨ ਜੋ ਮੈਂ ਐਕਸਪੀਰੀਅੰਸ ਕਰ ਰਹੀ ਹਾਂ ਉਹ ਮੈਂ ਆਪਦੇ ਦੋਸਤਾਂ ਨੂੰ ਵੀ ਹੈ ਜਿਹੜਾ ਉਹ ਐਕਸਪੀਰੀਅੰਸ ਹੈ ਜਿਹੜਾ ਉਹ ਕਰਵਾ ਸਕਾਂ ਸੋ ਜਦ ਜਦੋਂ ਕਿਤੇ ਵੀ ਮੈਂ ਕਿਤੇ ਨਵੀਂ ਜਗ੍ਹਾ ਦੇ ਉੱਤੇ ਘੁੰਮਣ ਜਾਂਦੀ ਹਾਂ ਨਵੇਂ ਕਿਸੇ ਦੋਸਤਾਂ ਨੂੰ ਮਿਲਦੀ ਹਾਂ ਜਾਂ ਫਿਰ ਮੈਂ ਆਪਣੇ ਪੁਰਾਣੇ ਵਿਛੜੇ ਦੋਸਤਾਂ ਨੂੰ ਮਿਲਦੀ ਹਾਂ ਤਾਂ ਉਦੋਂ ਮੈਂ ਤਸਵੀਰਾਂ ਹੈ ਜਿਹੜੀਆਂ ਕੈਮਰੇ ਦੇ ਨਾਲ ਜ਼ਰੂਰ ਖਿੱਚਣਾ ਪਸੰਦ ਕਰਦੀ ਹਾਂ ਤਾਂ ਕਿ ਉਹ ਮੈਮਰੀਜ਼ ਨੇ ਜਿਹੜੀਆਂ ਮੈਂ ਆਪਣੀ ਲਾਈਫ ਟਾਈਮ ਦੇ ਲਈ ਹੈ ਜਿਹੜੀ ਆਪਣੇ ਕੋਲ ਸੰਭਾਲ ਕੇ ਰੱਖ ਸਕਾਂ ਤਾਂ ਕਿ ਉਹ ਤਸਵੀਰਾਂ ਜਿਹੜੀਆਂ ਮੈਂ ਆਪਦੇ ਬੱਚਿਆਂ ਨੂੰ ਦਿਖਾ ਸਕਾਂ ਕਿ ਕਿਵੇਂ ਕਿਵੇਂ ਦੀਆਂ ਮੈਮਰੀਜ਼ ਨੇ ਜਿਹੜੀਆਂ ਮੈਂ ਉਹ ਆਪਣੇ ਜੀਵਨ ਦੇ ਵਿੱਚ ਕ੍ਰੀਏਟ ਕੀਤੀਆਂ ਹੋਈਆਂ ਹਨ ਕਿਹੜੇ ਕਿਹੜੇ ਐਕਸਪੀਰੀਅੰਸਿਸ ਨੇ ਜਿਹੜੇ ਮੈਂ ਉਹ ਲਏ ਹੋਏ ਹਨ ਕਈ ਵਾਰ ਇਹ ਤਸਵੀਰਾਂ ਮੈਂ ਖੁਦ ਵੀ ਦੇਖ ਦੁਬਾਰਾ ਦੇਖਣੀਆਂ ਜ਼ਰੂਰ ਪਸੰਦ ਕਰਦੀ ਹਾਂ ਕਿ ਕਈ ਵਾਰ ਇੱਦਾਂ ਦੀਆਂ ਮੈਮਰੀਜ਼ ਹੁੰਦੀਆਂ ਨੇ ਜਿਹੜੀਆਂ ਆਪ ਮੁਹਾਰੇ ਹੀ ਆਪਣੇ ਆਪਾਂ ਨੂੰ ਯਾਦ ਆ ਜਾਂਦੀਆਂ ਹਨ ਸੋ ਕੈਮਰੇ ਦੇ ਨਾਲ ਮੈਂ ਇਹੀ ਜੀਆਂ ਤਸਵੀਰਾਂ ਖਿੱਚ ਕੇ ਮੈਮਰੀਜ਼ ਕ੍ਰੀਏਟ ਕਰਕੇ ਆਪਣੇ ਕੋਲ ਸੰਭਾਲਣੀਆਂ ਅਤੇ ਆਪਣੇ ਨਾਲ ਦਿਆਂ ਨੂੰ ਦਿਖਾਉਣੀਆਂ ਵੱਧ ਪਸੰਦ ਕਰਦੀ ਹਾਂ